ਸਾਨੂੰ ਰਸ ਸਾਨੂੰ ਸਫ਼ਰ ਵਿੱਚ ਕਈ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਖਰਾਬ ਟਰੈਫਿਕ ਖਰਾਬ ਮੌਸਮ ਖੁਸ਼ ਖਸਤਾ ਹਾਲ ਸੜਕਾਂ ਤੰਗ ਸੜਕਾਂ ਜ਼ਮੀਨ ਖਿਸਕਣ ਜੰਗਲੀ ਜਾਨਵਰ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਖਰਾਬ ਟਰੈਫਿਕ ਕਰਕੇ ਅਸੀਂ ਦੋ ਦੋ ਤਿੰਨ ਤਿੰਨ ਘੰਟੇ ਟ੍ਰੈਫਿਕ ਵਿੱਚ ਹੀ ਫਸੇ ਰਹਿੰਦੇ ਆ ਟਰੈਫਿਕ ਨਹੀਂ ਨਿਕਲਦਾ ਜਿਸ ਕਰਕੇ ਅਸੀਂ ਟਰੈਫਿਕ ਵਿੱਚ ਫਸੇ ਰਹਿੰਦੇ ਹਾਂ ਖਰਾਬ ਮੌਸਮ ਕਰਕੇ ਕਈ ਵਾਰੀ ਬਾ ਮੌਸਮ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਅਸੀਂ ਸੜਕ 'ਤੇ ਹੀ ਫਸੇ ਰਹਿੰਦੇ ਹਾਂ ਜ਼ਿਆਦਾ ਖਰਾਬ ਹੋਣ ਕਰਕੇ ਅਸੀਂ ਦੋ ਦੋ ਤਿੰਨ ਤਿੰਨ ਦਿਨ ਜੇਕਰ ਮੌਸਮ ਸਹੀ ਨਹੀਂ ਹੁੰਦਾ ਤਾਂ ਸਾਨੂੰ ਸੜਕ 'ਤੇ ਹੀ ਨੇੜੇ ਤੇੜੇ ਕੋਈ ਨਿਵਾਸ ਸਥਾਨ ਦੇਖ ਕੇ ਉੱਥੇ ਰਹੇ ਰੁਕਣਾ ਪੈਂਦਾ ਹੈ ਖਸ ਹਾਲ ਖਸਤਾ ਹਾਲ ਸੜਕਾਂ ਖਸਤਾ ਹਾਲ ਸੜਕਾਂ ਜਿਹਨਾਂ ਨਾਲ ਵਰਖਾ ਦਾ ਪਾਣੀ ਭਰ ਜਾਂਦਾ ਹੈ ਅਤੇ ਲੰਘਣਾ ਟੱਪਣਾ ਔਖਾ ਹੋ ਜਾਂਦਾ ਹੈ ਬਹੁਤ ਹੀ ਕਠਿਨ ਹੋ ਜਾਂਦਾ ਹੈ ਅਜਿਹੀ ਮੁਸੀਬਤਾਂ ਨਾਲ ਨਜਿੱਠਣਾ ਬਹੁਤ ਹੀ ਔਖਾ ਹੈ ਖਸਤਾ ਹਾਲ ਸੜਕਾਂ ਤੰਗ ਸੜਕਾਂ ਤੰਗ ਸੜਕਾਂ ਬਹੁਤ ਹੀ ਪਤਲੀਆਂ ਅਤੇ ਛੋਟੀਆਂ ਹੁੰਦੀਆਂ ਹਨ ਇਸ 'ਤੇ ਇੱਕ ਹੀ ਵਾਹਨ ਆ ਜਾ ਸਕਦਾ ਹੈ ਜੇਕਰ ਸਾਹਮਣੇ ਕੋਈ ਦੂਸਰਾ ਵਾਹਨ ਆਉਂਦਾ ਹੈ ਤਾਂ ਸਾਨੂੰ ਕੱਚੇ ਰਸਤੇ 'ਤੇ ਆਪਣਾ ਵਾਹਨ ਉਤਾਰਨਾ ਪੈਂਦਾ ਹੈ ਤੰਗ ਸੜਕਾਂ ਖਿ ਜ਼ਮੀਨ ਖਿਸਕਣ ਕਈ ਵਾਰੀ ਬਾਰ ਬਾੜ ਮੌਸਮ ਭੁਚਾਲ ਆਉਣ ਕਰਕੇ ਸੜਕਾਂ ਖਿਸਕ ਜਾਂਦੀਆਂ ਹਨ ਜਿਸ ਕਰਕੇ ਸਾਨੂੰ ਵੱਡੇ ਤੋਂ ਵੱਡੇ ਮੋੜ ਮੋੜਨੇ ਪੈਂਦੇ ਹੈ ਜੋ ਕਿ ਸਾਨੂੰ ਬਹੁਤ ਹੀ ਦੂਰ ਪੈਂਦੇ ਹਨ ਜੰਗਲੀ ਜਾਨਵਰ ਰਸਤੇ ਵਿੱਚ ਕਈ ਵਾਰੀ ਜੋੜ ਖਿਸਕਣ ਕਰਕੇ ਸਾਨੂੰ ਜੰਗਲੀ ਰਸਤਿਆਂ ਵਿੱਚੋਂ ਲੰਘਣਾ ਪੈਂਦਾ ਹੈ ਜਿਸ ਵਿੱਚ ਜੰਗਲੀ ਜਾਨਵਰਾਂ ਦਾ ਸਾਹਮਣਾ ਵੀ ਬਹੁਤ ਵਾਰੀ ਹੋ ਜਾਂਦਾ ਹੈ ਇਸ ਨਾਲ ਨਜਿੱਠਣ ਲਈ ਅਸੀਂ ਬਹੁਤ ਹੀ ਸਾਵਧਾਨੀਆਂ ਵਰਤਦੇ ਹਾਂ